ਹਾਂ ਨਿਊਜ਼ ਮੀਡੀਆ ਪਿੰਡ ਵਿੱਚ ਕਾਫੀ ਖੇਤਰਾਂ ਬਾਰੇ ਮੁੱਦੇ ਚੱਕਦੀਆਂ ਰਹਿੰਦੀਆਂ ਜਿਵੇਂ ਨਸ਼ੇ ਬਾਰੇ ਟੁੱਟੀਆਂ ਸੜਕਾਂ ਬਾਰੇ ਪਿੰਡ ਦੇ ਵਿਕਾਸ ਬਾਰੇ ਇਸ ਬਾਰੇ ਤੇ ਮੈਂ ਮੀਡੀਆ ਵਿੱਚ ਬਹੁਤ ਸਾਰਾ ਕੁਝ ਆਉਂਦਾ ਰਹਿੰਦਾ ਹੈ ਪਰ ਜੇ ਉੱਥੇ ਦੇ ਬੱਚੇ ਨੂੰ ਇਹ ਪੜ੍ਹਦੇ ਹੋ ਤੇ ਉਥੋਂ ਉਸ ਬਾਰੇ ਕੁਝ ਨਹੀਂ ਆਂਦਾ ਉੱਥੇ ਦੀ ਅਨਪੜਤਾ ਉਦਾਂ ਹੀ ਵਧੀਆ ਵਧੀ ਹੋਈ ਹੈ ਲੋਕੀ ਅੱਠ ਦਸ ਕਰਕੇ ਬਸ ਆਪਣੇ ਕੰਮਾਂ ਕਾਰਜਾ ਵਿੱਚ ਪੈ ਜਾਂਦੇ ਹਨ ਧੰਨਵਾਦ